ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਚੰਡੀਗੜ੍ਹ ਨਰਸਰੀ ਤੋਂ ਬੋਲ ਰਹੀ ਹਾਂ ਮੈਂ ਗੁਰਪ੍ਰੀਤ ਕੌਰ ਗੱਲ ਕਰ ਰਹੀ ਹਾਂ ਇੱਥੇ ਦੀ ਓਨਰ ਹਾਂਜੀ ਮੇਰੇ ਕੋਲ ਕਈ ਤਰ੍ਹਾਂ ਦੇ ਫਲਾਵਰ ਵਾਲੇ ਹੈਗੇ ਹੈ ਬੂਟੇ ਤਾਂ ਤੁਸੀਂ ਕਿੱਦਾਂ ਦੇ ਪਸੰਦ ਕਰਦੇ ਹਾਂ ਮੈਨੂੰ ਤੁਸੀਂ ਥੋੜ੍ਹਾ ਜਿਹਾ ਆਪਣਾ ਆਈਡੀਆ ਦੱਸੋਂਗੇ ਹਾਂਜੀ ਹਾਂਜੀ ਤੁਸੀਂ ਇੱਕ ਵਾਰੀ ਸਾਡੀ ਨਰਸਰੀ ਵਿੱਚ ਆਓ ਉੱਥੇ ਵਿਜ਼ਿਟ ਕਰੋ ਅਤੇ ਤੁਹਾਨੂੰ ਮੈਂ ਸਾਰੇ ਆਈਡੀਆ ਦਿਆਂਗੀ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਪਸੰਦ ਆਏ ਤੁਸੀਂ ਮੈਨੂੰ ਦੱਸਿਓ ਸਾਡੇ ਕੋਲ਼ ਮਨੀ ਪਲਾਂਟ ਵੀ ਹੈਗੇ ਐਂ ਗੁਲਾਬ ਦੇ ਵੀ ਕਈ ਸਾਰੀ ਵਰੈਟੀਆਂ ਹੈਗੀਆਂ ਨੇ ਪਿਟੋਨੀਆ ਵੀ ਹੈਗਾ ਏ ਤੁਹਾਨੂੰ ਜਿੱਦਾਂ ਦੀ ਵੀ ਅੱਛੀ ਲੱਗਦੀ ਹੈ ਪਸੰਦ ਆਉਂਦੀ ਹੈਗੀ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਸਾਡੇ ਕੋਲ਼ ਆਰਟੀਫਿਸ਼ੀਅਲ ਘਾਹ ਵੀ ਹੈਗੀ ਹੈ ਜੇ ਤੁਸੀਂ ਉਹ ਵੀ ਪਸੰਦ ਕਰਦੇ ਆ ਲਵਾਉਣਾ ਚਾਹੁੰਦੇ ਐਂ ਤਾਂ ਅਸੀਂ ਉਹ ਵੀ ਲਗਾ ਸਕਦੇ ਹਾਂ ਬਾਕੀ ਤੁਸੀਂ ਆਪਣੀ ਬਾਲਕਨੀ ਵਾਸਤੇ ਚਾਹੀਦੇ ਆ ਤਾਂ ਉੱਥੇ ਦਾ ਅਸੀਂ ਸਕੇਅਰ ਫੁੱਟ ਦੇ ਹਿਸਾਬ ਨਾਲ਼ ਅਸੀਂ ਸਾਰਾ ਪੂਰਾ ਅੱਛੀ ਤਰ੍ਹਾਂ ਮੇਜ਼ਰਮੈਂਟ ਲੈ ਕੇ ਅਸੀਂ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੰਨਾ ਤੁਹਾਡਾ ਏ ਬਜਟ ਆਉਂਦਾ ਏ ਅਤੇ ਬਾਕੀ ਤੁਸੀਂ ਮੈਨੂੰ ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗਿਆ ਤੁਸੀਂ ਦੱਸ ਸਕਦੇ ਐਂ ਹਾਂਜੀ ਹਾਂਜੀ ਮੈਂ ਅਸੀਂ ਡਿਸਕਾਊਂਟ ਵੀ ਦਿੰਦੇ ਹਾਂ ਬਟ ਤੁਸੀਂ ਪਹਿਲੇ ਇੱਕ ਵਾਰੀ ਆਓ ਵਿਜ਼ਿਟ ਕਰੋ ਬਾਕੀ ਅਸੀਂ ਜਦ ਥੋੜ੍ਹਾ ਐਸਟੀਮੇਟ ਹੋ ਜਾਵੇਗਾ ਸਾਰਾ ਤੁਸੀਂ ਕਿੱਦਾਂ ਦੇ ਫਲਾਰਪੋਟ ਚਾਹੁੰਦੇ ਐਂ ਤੁਸੀਂ ਪੌਦੇ ਕਿੱਦਾਂ ਦੇ ਚਾਹੁੰਦੇ ਆ ਉਹਦੇ ਅਕੋਡਿੰਗ ਅਸੀਂ ਤੁਹਾਨੂੰ ਬਜਟ ਬਣਾ ਕੇ ਉਸ ਤੋਂ ਬਾਅਦ ਫਿਰ ਓਹਦੇ ਉੱਪਰ ਤੁਹਾਨੂੰ ਡਿਸਕਾਊਂਟ ਦਿਆਂਗੇ ਓਕੇ ਜੀ ਠੀਕ ਹੈ ਜੀ ਓਕੇ ਥੈਂਕ ਯੂ